ਪੁਰਾਣੇ ਮੋਬਾਈਲ ਫੋਨਾਂ ਵਿੱਚ ਬਟਨਾਂ ਵਾਲੀ ਫੋਨ ਹੁੰਦੇ ਸੀਗੇ ਅਤੇ ਉਹਦੇ ਵਿੱਚ ਆਪਾਂ ਨਾ ਤਾਂ ਵੀਡੀਓ ਕੋਲ ਕਰ ਸਕਦੇ ਸੀਗੇ ਜੇ ਕੋਲਿੰਗ ਵੀ ਕਰਨੀ ਹੁੰਦੀ ਸੀਗੀ ਤਾਂ ਉਹਦੇ ਬੜੇ ਪੈਸੇ ਲੱਗਦੇ ਹੁੰਦੇ ਸੀਗੇ ਠੀਕ ਹੈ ਹੁਣ ਜਿਹੜੇ ਮੋਬਾਇਲ ਫੋਨ ਨੇ ਉਹਨਾਂ ਦੀ ਸਕਰੀਨ ਵੱਡੀ ਹੈ ਉਹਦੇ ਵਿੱਚ ਆਪਾਂ ਮੂਵੀਜ਼ ਦੇਖ ਸਕਦੇ ਹਾਂ ਆਪਾਂ ਫਿਲਮਾਂ ਦੇਖ ਸਕਦੇ ਹਾਂ ਆਪਾਂ ਉਹਦੇ 'ਚ ਵੀਡੀਓ ਕੋਲ ਕਰ ਸਕਦੇ ਹਾਂ ਆਪਣੇ ਦੂਰ ਬੈਠੇ ਬੰਦੇ ਨਾਲ ਗੱਲ ਕਰ ਸਕਦੇ ਹਾਂ ਪਹਿਲਾਂ ਜਿਹੜਾ ਨੈਟਵਰਕ ਕਨੈਕਸ਼ਨ ਹੁੰਦਾ ਸੀਗਾ ਉਹ ਬਹੁਤ ਘੱਟ ਹੁੰਦਾ ਸੀਗਾ ਲੋਕ ਮਤਲਬ ਬਾਹਰ ਖਲੋ ਖਲੋ ਕੇ ਨੈਟਵਰਕ ਲੱਭਦੇ ਹੁੰਦੇ ਸੀਗੇ ਹੁਣ ਜਿਹੜੇ ਮੋਬਾਇਲ ਫੋਨ ਨੇ ਉਹ ਬਹੁਤ ਵਧੀਆ ਚਲਦੇ ਨੇ ਅਤੇ ਉਹਨਾਂ 'ਚ ਬਹੁਤ ਸਾਰੇ ਫਾਇਦੇ ਨੇ ਅਸੀਂ ਜੀਓ ਦਾ ਸਿਮ ਵਰਤਦੇ ਹਾਂ ਠੀਕ ਹੈ ਅਤੇ ਉਹ ਬਹੁਤ ਵਧੀਆ ਨੈਟਵਰਕ ਦਿੰਦਾ ਹੈ ਮੇਰੇ ਫੋਨ 'ਚ ਫਾਈਵ ਜੀ ਹੈ ਫਾਈਵ ਜੀ ਦੇ ਆਉਣ ਨਾਲ ਬਹੁਤ ਨੈਟਵਰਕ ਕਨੈਕਸ਼ਨ 'ਚ ਵਾਧਾ ਹੋਇਆ ਹੈ ਪਹਿਲਾਂ ਅਸੀਂ ਕੂਪਨ ਕਾਰਡ ਲੈ ਕੇ ਆਉਂਦੇ ਹੁੰਦੇ ਸਾਂ ਜੋ ਮਹਿੰਗੇ ਪੈਂਦੇ ਹੁੰਦੇ ਸੀਗੇ ਅਤੇ ਉਹਨਾਂ ਨੂੰ ਸਕਰੈਚ ਕਰਕੇ ਉਹਦਾ ਨੰਬਰ ਭਰ ਕੇ ਅਸੀਂ ਰੀਚਾਰਜ ਕਰ ਦਿੰਦੇ ਹਾਂ ਹੁਣ ਗੂਗਲ ਪੇ ਦੇ ਜ਼ਰੀਏ ਅਸੀਂ ਘਰ ਹੀ ਰਿਚਾਰਜ ਕਰ ਲੈਦੇ ਹਾਂ ਸਾਨੂੰ ਬਾਹਰ ਜਾਣਾ ਪੈਂਦਾ ਨਹੀਂ ਹੈ ਠੀਕ ਹੈ ਹੁਣ ਵਾਈ ਫਾਈ ਦਾ ਜ਼ਮਾਨਾ ਹੈ ਵਾਈ ਫਾਈ ਵੀ ਚਲਦਾ ਹੈ ਫੋਨਾਂ ਦੇ ਵਿੱਚ ਜਿਹਦੇ ਨਾਲ ਸਾਨੂੰ ਟੀ ਵੀ ਦੀ ਘੱਟ ਲੋੜ ਪੈਂਦੀ ਹੈ ਅਸੀਂ ਸਭ ਕੁਛ ਫੋਨ 'ਤੇ ਹੀ ਦੇਖ ਸਕਦੇ ਹਾਂ ਇਹਨਾਂ ਫੋਨਾਂ ਨਵੇਂ ਫੋਨਾਂ ਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਮੈਂ ਹਰ ਮਹੀਨਾ ਟੂ ਥਟੀ ਨਾਈਨ ਦਾ ਰਿਚਾਰਜ ਕਰਾਉਂਦੀ ਹਾਂ ਅਤੇ ਇਹ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ ਇਹਦੇ ਵਿੱਚ ਸਾਨੂੰ ਡੇਢ ਜੀ ਬੀ ਮਿਲਦੀ ਹੈ ਅਤੇ ਅਸੀਂ ਅਨਲਿਮਿਟਡ ਕੋਲਿੰਗ ਕਰ ਸਕਦੇ ਹਾਂ ਜਿੱਦਾਂ ਪਹਿਲਾਂ ਕੋਲਿੰਗ ਕਰਨ ਦੇ ਬਹੁਤ ਪੈਸੇ ਲੱਗਦੇ ਹੁੰਦੇ ਹੁੰਦੇ ਸੀਗੇ ਹੁਣ ਬਹੁਤ ਘੱਟ ਪੈਸਿਆਂ ਦੇ ਵਿੱਚ ਹੀ ਅਸੀਂ ਘੰਟਾ ਘੰਟਾ ਭਰ ਗੱਲਾਂ ਕਰ ਸਕਦੇ ਹਾਂ ਇਸ ਟੈਕਨੋਲਜੀ ਕਰਕੇ ਸਾਨੂੰ ਬਹੁਤ ਫਾਇਦਾ ਹੋਇਆ ਹੈ ਇਸ ਕਰਕੇ ਸਾਨੂੰ ਇਹ ਧੰਨਵਾਦੀ ਹੋਣਾ ਚਾਹੀਦਾ ਹੈ